ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਬੀਤੇ ਐਤਵਾਰ ਨੂੰ ਮੇਰੇ ਘਰ ਪਾਰਟੀ ਸੀਗਾ ਜਿਹਦੇ ਦੌਰਾਨ ਮੈਂ ਸਵੀਗੀ ਤੋਂ ਔਰਡਰ ਕੀਤਾ ਸੀਗਾ ਕਾਫ਼ੀ ਜ਼ਿਆਦਾ ਸਮਾਨ ਪਰ ਔਡਰ ਮੇਰੇ ਘਰ ਡਿਲੀਵਰੀ ਨਾ ਹੋਣ ਕਰਕੇ ਮੈਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਕਾਰਨ ਮੈਨੂੰ ਆਪਣੀ ਕਾਫ਼ੀ ਜ਼ਿਆਦਾ ਬੇਇੱਜ਼ਤੀ ਵੀ ਮਹਿਸੂਸ ਹੋਈ ਆਪਣੇ ਯਾਰਾਂ ਦੋਸਤਾਂ ਅੱਗੇ ਮੇਰੇ ਯਾਰ ਦੋਸਤ ਮੇਰੇ ਕੋਲ ਪੁੱਛ ਰਹੇ ਸਨ ਕਿ ਤੇਰਾ ਔਡਰ ਹਾਲੇ ਤੱਕ ਨਹੀਂ ਆਇਆ ਪਰ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਮੈਂ ਵਾਰ ਵਾਰ ਤੁਹਾਨੂੰ ਜਿਹੜਾ ਐਗਜੀਕਿਉਟਿਵ ਸੀਗਾ ਉਹਨੂੰ ਵਾਰ ਵਾਰ ਫ਼ੋਨ ਕਰਕੇ ਪੁੱਛਣ ਦੀ ਟਰਾਈ ਕਰ ਰਿਹਾ ਸੀਗਾ ਕਿ ਮੇਰਾ ਔਡਰ ਅਜੇ ਤੱਕ ਕਿੱਥੇ ਆ ਪਰ ਉਹ ਮੇਰਾ ਅੱਗੋਂ ਦੀ ਫ਼ੋਨ ਪਿਕ ਨਹੀਂ ਕਰ ਰਿਹਾ ਸੀਗਾ ਦੱਸੋ ਉਹਦੇ ਵਿੱਚ ਮੇਰੀ ਗਲਤੀ ਕੀ ਹੈ ਉੱਤੋਂ ਦੀ ਮੈਂ ਆਪਣਾ ਔਡਰ ਕੈਂਸਲ ਵੀ ਕਰ ਦਿੱਤਾ ਬਟ ਮੇਰਾ ਔਡਰ ਫਿਰ ਵੀ ਮੈਨੂੰ ਸ਼ੋਅ ਹੋਈ ਜਾ ਰਿਹਾ ਸੀਗਾ ਰੀਪ੍ਰਜੈਂਟਿਵਟਿਵ ਦੇ ਬਾਅਦ ਦੇ ਬਾਅਦ 'ਚੋਂ ਮੈਨੂੰ ਫ਼ੋਨ ਆਉਣ 'ਤੇ ਮੇਰੇ ਔਡਰ ਕੈਂਸਲ ਕਰਨ 'ਤੇ ਕੋਲ ਆ ਰਹੇ ਸਨ ਜੋ ਕਿ ਮੈਂ ਵੀ ਨਹੀਂ ਚੁੱਕੇ ਔਡਰ ਕੈਂਸਲ ਕਰਨ ਤੋਂ ਬਾਅਦ 'ਚੋਂ ਮੇਰਾ ਜਿਹੜਾ ਰਿਫੰਡ ਸੀਗਾ ਉਹ ਅਜੇ ਤੱਕ ਮੇਰੇ ਐਪ ਵਿੱਚ ਨਹੀਂ ਸ਼ੋਅ ਹੋ ਰਿਹਾ ਮੈਨੂੰ ਪਲੀਜ਼ ਦੱਸਿਆ ਜਾਵੇ ਕਿ ਮੇਰਾ ਰਿਫੰਡ ਕਦੋਂ ਅਤੇ ਕਿੰਨੇ ਟਾਈਮ ਤੱਕ ਆਵੇਗਾ ਤਾਂ ਕਿ ਮੈਂ ਅਗਲਾ ਆਪਣਾ ਔਡਰ ਵੀ ਕਰਨ ਦਾ ਸੋਚ ਸਕਾਂ ਵਰਨਾ ਉਦੋਂ ਤੱਕ ਮੈਂ ਅਗਲਾ ਆਪਣਾ ਔਡਰ ਵੀ ਨਹੀਂ ਕਰਾਂਗਾ